ਜਦੋਂ ਅਸੀਂ ਹਸਪਤਾਲਾਂ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ ਸਭ ਤੋਂ ਜ਼ਿਆਦਾ ਹਸਪਤਾਲ ਪਾਏ ਜਾਂਦੇ ਹਨ ਇੱਥੇ ਸਰਕਾਰੀ ਅਤੇ ਗੈਰ ਸਰਕਾਰੀ ਕਈ ਹਸਪਤਾਲ ਪਾਏ ਜਾਂਦੇ ਹਨ ਜਿਨ੍ਹਾਂ ਵਿੱਚ ਕਿ ਲੋਕ ਆਪਣਾ ਇਲਾਜ ਬਿਹਤਰ ਕਰਵਾਉਂਦੇ ਨੇ ਜਦੋਂ ਕਰੋਨਾ ਕਾਲ ਆਇਆ ਸੀ ਉਸ ਦੌਰਾਨ ਵੀ ਇਹਨਾਂ ਹਸਪਤਾਲਾਂ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਵੈਕਸੀਨੇਸ਼ਨ ਵਿੱਚ ਵੀ ਇਹਨਾਂ ਨੇ ਲੋਕਾਂ ਦਾ ਸਾਥ ਦਿੱਤਾ ਇੱਥੇ ਜਲੰਧਰ ਵਿੱਚ ਜਿਹੜੇ ਵੀ ਪ੍ਰਾਈਵੇਟ ਕੰਮ ਕਰਦੇ ਨੇ ਜਿਵੇਂ ਫੈਕਟਰੀਆਂ 'ਚ ਲੇਬਰ ਕੰਮ ਕਰਦੀ ਹੈ ਉਹਨਾਂ ਲਈ ਇਹ ਸਰਕਾਰ ਵੱਲੋਂ ਕੁਛ ਕਾਰਡ ਈ ਐਸ ਆਈ ਕਾਰਡ ਵੀ ਉਪਲਬਧ ਕਰਵਾਏ ਜਾਂਦੇ ਹਨ ਜਿਨ੍ਹਾਂ ਰਾਹੀਂ ਉਹ ਆਪਣੇ ਅਤੇ ਆਪਣੇ ਪਰਿਵਾਰ ਦਾ ਫਰੀ ਇਲਾਜ ਕਰਵਾਉਂਦੇ ਹਨ ਅਤੇ ਹੋਰ ਵੀ ਚੀਜ਼ਾਂ ਕਰਕੇ ਇਹ ਸਹੂਲਤਾਂ ਲਈਆਂ ਜਾਂਦੀਆਂ ਹਨ ਜਿਵੇਂ ਕਿ ਬੀ ਪੀ ਐਲ ਕਾਰਡ ਵੀ ਇੱਥੇ ਉਪਲਬਧ ਹੈ ਜਿਹੜੇ ਕਿ ਸਰਕਾਰੀ ਹਸਪਤਾਲਾਂ ਜਿਵੇਂ ਸਿਵਲ ਹਸਪਤਾਲਾਂ 'ਚ ਵੀ ਲਾਗੂ ਹੁੰਦਾ ਹੈ